ਹੈਲੋ ਕੀ ਤੁਸੀਂ ਬਜਰੰਗੀ ਨਰਸਰੀ ਚੋਂ ਬੋਲ ਰਹੇ ਸਾਨੂੰ ਨਰਸਰੀ ਵਾਸਤੇ ਜਿਹੜੇ ਗਰਮੀਆਂ 'ਚ ਬੂਟੇ ਲਗਾਉਣੇ ਉਹ ਅੰਦਰ ਰੱਖਣ ਵਾਸਤੇ ਕਿਹੜੇ ਕਿਹੜੇ ਬੂਟੇ ਤੁਹਾਡੇ ਨਰਸਰੀ ਵਿਚ ਹਨ ਅਸੀਂ ਤੁਹਾਡੇ ਤੋਂ ਗਮਲੇ ਅਤੇ ਸਟੈਂਡ ਵਗੈਰਾ ਵੀ ਖਰੀਦਣੇ ਹਨ ਅਸੀਂ ਇਹੋ ਜਿਹੇ ਬੂਟੇ ਚਾਹੁੰਦੇ ਹਨ ਜਿਹੜੇ ਗਰਮੀ ਵਿੱਚ ਬਾਹਰ ਵੀ ਅਤੇ ਅੰਦਰ ਚਲ ਸਕਣ ਅਤੇ ਜਿਹਦੀ ਕਿ ਪਾਣੀ ਦੀ ਅੱਜ ਕੱਲ੍ਹ ਜ਼ਿਆਦਾ ਵਰਤੋਂ ਹੁੰਦੀ ਹਨ ਅਸੀਂ ਚਾਹੁੰਦੇ ਹਾਂ ਕੇ ਤੁਸੀਂ ਸਾਨੂੰ ਇਹੋ ਜਿਹੇ ਬੂਟੇ ਦੇਣਗੇ ਜੋ ਕਿ ਗਰਮੀਆਂ ਵਿੱਚ ਚੰਗੀ ਤਰ੍ਹਾਂ ਚੱਲ ਸਕਣ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਓਕੇ